ਸਾਡੇ ਪੰਜਾਬ ਦੇ ਵਿੱਚ ਹੈਲਥ ਕੇਅਰ ਸਿਸਟਮ ਬਹੁਤ ਵਧੀਆ ਪਰ ਜੇਕਰ ਮੈਂ ਆਪਣੇ ਗੱਲ ਕਰਾਂ ਪੰਜਾਬ ਦੀ ਤਾਂ ਫਿਰ ਪੰਜਾਬ ਦੇ ਵਿੱਚ ਲੋਕ ਜ਼ਿਆਦਾਤਰ ਲੋਕ ਸਰਕਾਰੀ ਹਸਪਤਾਲਾਂ ਵਿੱਚ ਜਾਣਾ ਪਸੰਦ ਕਰਦੇ ਹਨ ਕਿਉਂਕਿ ਉੱਥੇ ਪੰਜ ਲੱਖ ਪੰਜ ਲੱਖ ਤੱਕ ਦਾ ਇਲਾਜ ਫ੍ਰੀ ਹੁੰਦਾ ਅਤੇ ਉੱਥੇ ਦਵਾਈਆਂ ਵੀ ਵਧੀਆ ਮਿਲਦੀਆਂ ਹਨ ਅਤੇ ਸਸਤੀਆਂ ਮਿਲਦੀਆਂ ਹਨ ਅਤੇ ਮਤਲਬ ਇੱਦਾਂ ਜੇ ਉੱਥੇ ਸਰਕਾਰੀ ਡਾਕਟਰ ਹੁੰਦੇ ਹੈ ਜਿਹੜੇ ਕਿ ਉੱਥੇ ਪੜ੍ਹੇ ਲਿਖੇ ਹੁੰਦੇ ਹਨ ਅਤੇ ਮਤਲਬ ਸਰਕਾਰੀ ਡਾਕਟਰ ਆ ਜਿਹੜੇ ਪੜ੍ਹੇ ਲਿਖੇ ਅਤੇ ਉੱਥੇ ਮੈਡੀਕਲ ਸਿਸਟਮ ਵੀ ਬਹੁਤ ਵਧੀਆ ਅਤੇ ਪਹਿਲਾਂ ਦੇ ਸਮੇਂ ਦੇ ਵਿੱਚ ਮਤਲਬ ਬਿਲਡਿੰਗਾਂ ਮਤਲਬ ਸਾਫ਼ ਸਫ਼ਾਈ ਘੱਟ ਹੁੰਦੀ ਸੀਗੀ ਪਰ ਹੁਣ ਦੇ ਟਾਈਮ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀ ਸ ਮਤਲਬ ਸਾਰੇ ਹੀ ਉੱਥੇ ਬਿਲਡਿੰਗਾਂ ਉੱਥੇ ਦੀਆਂ ਸਾਰੀਆਂ ਸਾਫ਼ ਹੁੰਦੀਆਂ ਨੇ ਅਤੇ ਮਤਲਬ ਉੱਥੇ ਦੇ ਸਾਰੇ ਮਤਲਬ ਨਰਸਾਂ ਵੀ ਮਤਲਬ ਉੱਥੇ ਮਤਲਬ ਮਤਲਬ ਬਹੁਤ ਵਧੀਆ ਉੱਥੇ ਦਾ ਕੰਮ ਕਰਦੀਆਂ ਮਰੀਜ਼ਾਂ ਦਾ ਅਤੇ ਮਤਲਬ ਪਹਿਲਾਂ ਦੇ ਟਾਈਮ ਵਾਲੀ ਹੁਣ ਗੱਲ ਹੈ ਨਹੀਂ ਪਹਿਲਾਂ ਦੇ ਟਾਈਮ ਦੇ ਵਿੱਚ ਮਤਲਬ ਮਤਲਬ ਡਾਕਟਰ ਮਤਲਬ ਮਰੀਜ਼ਾਂ ਦੀ ਬਹੁਤ ਘੱਟ ਸੁਣਦੇ ਸੀਗੇ ਪਰ ਹੁਣ ਹਰ ਇੱਕ ਕਿਸੇ ਮਰੀਜ਼ ਦੀ ਸੁਣੀ ਜਾਂਦੀ ਹੈ ਅਤੇ ਉਹਦਾ ਚੰਗੀ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ